ਜੀ ਮੈਂ ਦੌੜਾਂ ਲਗਾਉਣ ਰੋਜ਼ ਜਾਂਦਾ ਹਾਂ ਅਤੇ ਮੈਂ ਜ਼ਿਆਦਾਤਰ ਆਪਣੇ ਦੋਸਤਾਂ ਨਾਲ ਜਾਂਦਾ ਹਾਂ ਮੈਂ ਕਿਸੇ ਕਲੱਬ ਦਾ ਵਿੱਚ ਸ਼ਾਮਿਲ ਨਹੀਂ ਹਾਂ ਪਰ ਅਸੀਂ ਜਦੋਂ ਵੀ ਇਕੱਠੇ ਦੋਸਤਾਂ ਨਾਲ ਸਮੂਹ ਦੇ ਵਿੱਚ ਦੌੜਦੇ ਹਾਂ ਤਾਂ ਬੜਾ ਹੀ ਆਨੰਦ ਆਉਂਦਾ ਹੈ ਸਾਡੇ ਘਰ ਦੇ ਨੇੜੇ ਹੀ ਇੱਕ ਪਾਰਕ ਹੈ ਜਿੱਥੇ ਅਸੀਂ ਸਾਰੇ ਦੌੜ ਲਗਾਉਣ ਜਾਂਦੇ ਹਾਂ ਅਸੀਂ ਸ਼ਾਮ ਨੂੰ ਪੰਜ ਛੇ ਵਜੇ ਉੱਥੇ ਦੌੜ ਲਗਾਉਣ ਜਾਂਦੇ ਹਾਂ ਅਤੇ ਸੱਤ ਵਜੇ ਤੱਕ ਉੱਥੇ ਦੌੜਦੇ ਹਾਂ ਸਾਰੇ ਇਕੱਠੇ ਦੌੜਦੇ ਹਾਂ ਅਤੇ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਹਾਂ ਕਿ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਦੌੜ ਲਗਾਉਣ ਅਤੇ ਸਾਰੇ ਸਿਹਤ ਪੱਖੋਂ ਤੰਦਰੁਸਤ ਰਹਿਣ